ਪੰਦਰਾਂ ਅਗਸਤ ਉੱਨੀ ਸੌ ਸੰਤਾਲੀ ਛੱਬੀ ਜਨਵਰੀ ਉੱਨੀ ਸੌ ਪੰਜਾਹ ਪੱਚੀ ਅਗਸਤ ਉੱਨੀ ਸੌ ਸਤਾਸੀ ਇੱਕ ਜਨਵਰੀ ਦੋ ਹਜ਼ਾਰ ਅਠਾਰ੍ਹਾਂ ਚੌਦਾਂ ਜਨਵਰੀ ਦੋ ਹਜ਼ਾਰ ਪੰਦਰਾਂ